ਜੇਕਰ ਖੇਡ ਨਾਲ ਸੰਬੰਧਿਤ ਕੋਈ ਹਿੰਸਾ ਦੇ ਮੁੱਦੇ ਹਨ ਤਾਂ ਸਾਡੇ ਖੇਤਰ ਦੇ ਖੇਡ ਖੇਤਰ ਵਿੱਚ ਉਸ ਹਿੰਸਾ ਨੂੰ ਵੱਧ ਤੋਂ ਵੱਧ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ